ਇੱਕ ਵਾਰੀ ਅਸੀਂ ਚਿੜੀਆ ਘਰ ਘੁੰਮਣ ਗਏ ਅਤੇ ਉੱਥੇ ਬਹੁਤ ਸਾਰੇ ਜਾਨਵਰ ਬਹੁਤ ਸਾਰੇ ਪੰਛੀ ਸਨ ਉਹਨਾਂ ਦਾ ਬਹੁਤ ਹੀ ਇੱਕ ਅਦਭੁਤ ਨਜ਼ਾਰਾ ਸੀ ਅਤੇ ਉਸ ਟਾਈਮ ਮੈਂ ਉਹਨਾਂ ਦੇ ਨਜ਼ਾਰੇ ਨੂੰ ਉਹਨਾਂ ਦਾ ਜਿਹੜਾ ਵੀ ਅੰਦਾਜ਼ ਸੀ ਉਹਨਾਂ ਨੂੰ ਆਪਣੀ ਫੋਟੋਗ੍ਰਾਫੀ ਦੇ ਥਰੂ ਫੋਟੋਗ੍ਰਾਫੀ ਦੇ ਨਾਲ ਕੈਮਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਬਹੁਤ ਸਾਰੇ ਜਾਨਵਰ ਸਨ ਜਿਹਨਾਂ ਦਾ ਜਿਹਨਾਂ ਨੂੰ ਮੈਂ ਕੈਮਰੇ ਦੇ ਥਰੂ ਆਪਣੇ ਫੋਟੋਆਂ ਦੇ ਵਿੱਚ ਕੈਦ ਕੀਤਾ ਤੇ ਉਸ ਟਾਈਮ ਇੱਕ ਬਾਂਦਰ ਨੇ ਮੇਰੇ ਕੈਮਰੇ ਨੂੰ ਖੋਹ ਲੈਣ ਦੀ ਕੋਸ਼ਿਸ਼ ਕੀਤੀ ਫੇਰ ਉਸ ਤੋਂ ਬਾਅਦ ਉੱਥੇ ਬਹੁਤ ਸਾਰੇ ਗਾਈਡਮੈਨ ਅਤੇ ਸਿਕਿਉਰਿਟੀ ਮੈਨ ਸੀ ਜਿਹਨਾਂ ਨੇ ਮੈਨੂੰ ਉਸ ਬਾਂਦਰ ਦੇ ਹਮਲੇ ਤੋਂ ਬਚਾਇਆ ਅਤੇ ਮੇਰੇ ਕੈਮਰੇ ਨੂੰ ਵੀ ਬਚਾਇਆ ਅਤੇ ਇਸ ਤਰੀਕੇ ਦੇ ਨਾਲ ਮੈਂ ਉਨਾਂ ਗਾਈਡਮੈਨ ਅਤੇ ਸਕਿਉਰਿਟੀ ਮੈਨ ਦੀ ਮਦਦ ਦੇ ਨਾਲ ਉਸ ਬਾਂਦਰ ਤੋਂ ਬਚੀ ਅਤੇ ਮੈਂ ਇਸ ਤਰੀਕੇ ਨਾਲ ਉਸ ਕੈਮ ਫੋਟੋਗ੍ਰਾਫੀ ਕਰਦਿਆਂ ਟਾਈਮ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕੀਤਾ